ਅਠਾਈ ਅਗਸਤ ਦੋ ਹਜ਼ਾਰ ਦਸ ਛੱਬੀ ਫਰਵਰੀ ਦੋ ਹਜ਼ਾਰ ਅਠਾਰਾਂ ਤੇਰਾਂ ਜਨਵਰੀ ਦੋ ਹਜ਼ਾਰ ਤੇਈ ਸੋਲਾਂ ਮਈ ਦੋ ਹਜ਼ਾਰ ਅਠਾਰਾਂ ਅਪ੍ਰੈਲ ਉੱਨੀ ਸੌ ਉਣਾਨਵੇਂ